ਹੈਲੋ ਹਾਂਜੀ ਸਰ ਹੁਸਨਪ੍ਰੀਤ ਸਿੰਘ ਗੱਲ ਕਰਦਾ ਸੀ ਜੀ ਜੀ ਸਰ ਸਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਜੀ ਪੰਜਾਬ ਦੇ ਵਿੱਚ ਜੋਬ ਓਪਰਚੁਨਿਟੀ ਬਾਰੇ ਮੈਨੂੰ ਥੋੜ੍ਹਾ ਜਿਹਾ ਦੱਸੋਂਗੇ ਕੋਈ ਗਿਆਨ ਮੈਂ ਸਰ ਕੁਆਲੀਫਿਕੇਸ਼ਨ ਮੇਰੀ ਹੈਗੀ ਹੈਗੀ ਬੀ ਏ ਹੈ ਬੀਐਡ ਐਮ ਏ ਇੰਗਲਿਸ਼ ਹੈ ਜੀ ਮੇਰੇ ਕੋਲੇ ਸੀ ਜੀ ਫਿਜੀਕਲ ਹਿਸਟਰੀ ਪੋਲੀਟੀਕਲ ਸਾਇੰਸ ਇੰਗਲਿਸ਼ ਇਲੈਕਟਿਵ ਆਡੀਸ਼ਨਲ

ਬੀਐਡ ਸਰ ਮੈ ਕੀਤੀ ਹੈ ਐਸ ਐਸ ਟੀ ਅਤੇ ਇੰਗਲਿਸ਼ ਨਾਲ ਜੀ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਦੀ ਐਮ ਏ ਇੰਗਲਿਸ਼

ਹਾਂਜੀ ਹਾਂਜੀ ਹਾਂਜੀ ਸਰ ਠੀਕ ਹੈ ਜੀ ਠੀਕ ਹੈ ਸਰ ਮੇਰਾ ਟੈਟ ਨਹੀਂ ਕਲੀਅਰ ਹੈਗਾ ਜੀ ਉਹਨਾਂ 'ਚ ਮੈਂ ਤਾਂ ਕਰਕੇ ਅਪਲਾਈ ਨਹੀਂ ਕਰ ਸਕਿਆ ਹੂੰ ਠੀਕ ਹੈ ਜੀ ਸਰ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਮੈਨੂੰ ਕੋਈ ਦੱਸ ਸਕਦੇ ਹੋ ਮੈਂ ਕਿੱਥੇ ਜੋਬ ਕਰ ਸਕਦਾ ਠੀਕ ਹੈ ਜੀ

ਕਿਸੇ ਇੰਡਸਟਰੀ ਏਰੀਏ ਦੇ ਵਿੱਚ ਮੇਰੀ ਪੜ੍ਹਾਈ ਦੀ ਵੈਲਿਊ

ਠੀਕ ਹੈ ਜੀ ਸਰ ਬਸ ਜੀ ਸਰ ਇੰਨਾ ਹੀ ਪੁੱਛਣਾ ਸੀਗਾ ਜੀ ਓਕੇ ਜੀ ਥੈਂਕ ਯੂ ਜੀ ਹਾਂਜੀ ਹਾਂਜੀ ਥੈਂਕ ਯੂ ਸਰ